ਪੰਜਾਬ ਦੇ ਵਿੱਚ ਪ੍ਰਮੁੱਖ ਯੂਨੀਵਰਸਿਟੀਆਂ ਦੇ ਵਿੱਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਬਠਿੰਡਾ ਅਤੇ ਤਕਨੀਕੀ ਯੂਨੀਵਰਸਿਟੀ ਜਲੰਧਰ ਜੋ ਕਿ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਪ੍ਰਦਾਨ ਕਰ ਰਹੇ ਹਨ ਉਹਨਾਂ ਦੇ ਵਿੱਚ ਜਿਹੜੇ ਕੋਰਸ ਹੈਗੇ ਹੈ ਉਹ ਬੜੇ ਵਧੀਆ ਅੱਜ ਕੱਲ੍ਹ ਸ਼ੁਰੂ ਕੀਤੇ ਗਏ ਹਨ ਜਿਹਨਾਂ ਦੇ ਵਿੱਚ ਇੰਜੀਨੀਅਰਿੰਗ ਕੋਰਸਿਸ ਵੀ ਹਨ ਅਤੇ ਦੂਸਰੇ ਕੋਰਸਿਸ ਜਿਹੜੇ ਆਪਾਂ ਕਹਿ ਲਈਏ ਅੱਜ ਕੱਲ੍ਹ ਦੇ ਜਿਹੜੇ ਸਮੇਂ ਦੀ ਲੋੜ ਮੁ ਮੁਤਾਬਿਕ ਜਿਹੜੇ ਹੈਗੇ ਹੈ ਕੋਰਸ ਜਿਹੜੇ ਹੈਗੇ ਹੈ ਜਿਵੇਂ ਆਪਾਂ ਆਰਟੀਫਿਸ਼ਲ ਇਟੇਲੀਜੇਸ ਲਾ ਲਈਏ ਜਾਂ ਹੋਰ ਲਾ ਲਈਏ ਇਸ ਪ੍ਰਕਾਰ ਦੇ ਕੋਰਸ ਵੀ ਜਿਹੜੇ ਹੈਗੇ ਹੈ ਉਹ ਸ਼ੁਰੂ ਕੀਤੇ ਗਏ ਹਨ ਤਾਂ ਜੋ ਵਿਦਿਆਰਥੀ ਦੇ ਵਿੱਚ ਉਹਨਾਂ ਦੀ ਪ੍ਰਸਨੈਲਟੀ ਦੇ ਵਿੱਚ ਉਹਨਾਂ ਦੇ ਅੱਗੇ ਆਉਣ ਵਾਲੇ ਭਵਿੱਖ ਵਿੱਚ ਜਿਹੜੇ ਹੈਗੇ ਹੈ ਉਹ ਕੰਮ ਆ ਸਕਣ ਧੰਨਵਾਦ